ਭੰਗੜਾ ਇੱਕ ਪੰਜਾਬੀ ਲੋਕ ਨਾਚ ਹੈ ਲੋਕ ਇਸ ਨੂੰ ਕਰਨਾ ਬਹੁਤ ਪਸੰਦ ਕਰਦੇ ਹਨ ਜਿਵੇਂ ਕਿ ਦੇਖਿਆ ਜਾਵੇ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਸਮੇਂ ਸਮੇਂ 'ਤੇ ਪ੍ਰਤਿਯੋਗਿਤਾ ਕਰਵਾਈ ਜਾਂਦੀ ਹੈ ਜਿਹਦੇ ਵਿੱਚ ਬੱਚੇ ਬਹੁਤ ਖੁਸ਼ੀ ਦੇ ਨਾਲ ਭਾਗ ਲੈਂਦੇ ਹਨ ਅਤੇ ਭੰਗੜਾ ਤਿਆਰ ਕਰਕੇ ਲੋਕਾਂ ਨੂੰ ਪ੍ਰਦਰਸ਼ਿਤ ਕਰਦੇ ਹਨ ਸਾਡੇ ਪੰਜਾਬੀ ਕਲਚਰ ਦੇ ਵਿੱਚ ਲੋਕ ਵਿਆਹਾਂ ਅਤੇ ਜਾਗੋ ਦੇ ਫੰਕਸ਼ਨਾਂ ਦੇ ਉੱਪਰ ਵੀ ਭੰਗੜਾ ਕਰਦੇ ਹਨ ਇਹਦੇ ਨਾਲ ਸਾਡਾ ਭਾਈਚਾਰਾ ਬਹੁਤ ਹੀ ਇੱਕ ਸਾਰ ਰਹਿੰਦਾ ਹੈ ਅਤੇ ਭੰਗੜਾ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਵਧੀਆ ਯੋਗਦਾਨ ਪ੍ਰਦਾਨ ਕਰਦਾ ਹੈ ਇਹਦੇ ਨਾਲ ਸਾਡਾ ਭਾਈਚਾਰਾ ਇੱਕ ਦੂਜੇ ਨਾਲ ਮਿਲ ਕੇ ਰਹਿੰਦਾ ਹੈ ਇੱਕ ਦੂਜੇ ਦੇ ਨਾਲ ਮਿਲਣ ਦੀਆਂ ਭਾਵਨਾਵਾਂ ਵਧਾਉਂਦਾ ਹੈ ਅਤੇ ਇਹਦੇ ਨਾਲ ਭੰਗੜੇ ਨਾਲ ਭਾਈਚਾਰਾ ਬਹੁਤ ਹੀ ਇੱਕ ਗੱਠ ਹੋ ਕੇ ਰਹਿੰਦਾ ਹੈ ਜਿਵੇਂ ਕਿ ਦੇਖਿਆ ਜਾਵੇ ਜਾਗੋ ਦੇ ਵਿੱਚ ਇੱਕ ਬੜਾ ਭਾਈ ਅਤੇ ਛੋਟਾ ਭਾਈ ਇੱਕ ਦੂਜੇ ਦੇ ਨਾਲ ਰਲ ਕੇ ਭੰਗੜਾ ਕਰਦਾ ਹੈ ਜਿਹਦੇ ਨਾਲ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਉੱਠਦੀ ਹੈ ਅਤੇ ਉਹਨਾਂ ਦੇ ਆਪਸੀ ਤਾਲਮੇਲ ਬਹੁਤ ਚੰਗੇ ਹੁੰਦੇ ਅਤੇ ਉਹਨਾਂ ਦੇ ਆਪਸੀ ਤਾਲਮੇਲ ਬਹੁਤ ਚੰਗੇ ਹੁੰਦੇ ਹਨ ਦੂਜੇ ਪਾਸੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹ ਚੀਜ਼ ਨੂੰ ਉਹ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਤਾਂ ਕਿ ਬੱਚੇ ਦਾ ਸੈਲਫ ਕਨਫੀਡੈਂਸ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੀ ਚੰਗਾ ਹੋਵੇ ਉਹ ਹਰ ਇੱਕ ਫੀਲਡ ਦੇ ਵਿੱਚ ਪ ਪਹਿਲ ਨੰਬਰ 'ਤੇ ਹੋਵੇ ਭੰਗੜਾ ਦੇਖਿਆ ਜਾਵੇ ਤਾਂ ਭੰਗੜਾ ਐਰੋਬਿਕ ਭਾਈਚਾਰੇ ਦੀ ਜਾਨ ਹੈ ਅਤੇ ਇਹ ਅੱਜ ਦੇ ਸਮਾਜ ਦੇ ਵਿੱਚ ਬਹੁਤ ਹੀ ਚੰਗਾ ਯੋਗਦਾਨ ਪ੍ਰਦਾਨ ਕਰਦੀ ਹੈ ਹੋਰ ਪਾਸੇ ਦੇਖਿਆ ਜਾਵੇ ਤਾਂ ਇਹ ਸਾਡੇ ਹੈਲਥ ਜਿਵੇਂ ਕਿ ਸਾਡੀ ਫਿਜੀਕਲ ਹੈਲਥ ਦੇ ਲਈ ਵੀ ਭੰਗੜਾ ਬਹੁਤ ਹੀ ਚੰਗਾ ਹੈ